ਪੈਂਤੀ ਲੱਖ ਚਾਲੀ ਹਜ਼ਾਰ ਪੰਜ ਸੌ ਛਿਆਹਠ ਤੀਹ ਹਜ਼ਾਰ ਨੌ ਸੌ ਨੜਿਨਵੇਂ ਤਿੰਨ ਲੱਖ ਚਾਰ ਹਜ਼ਾਰ ਪੰਜ ਸੌ ਪਚਾਨਵੇਂ ਛਿਆਹਠ ਹਜ਼ਾਰ ਨੌ ਸੌ ਬਹੱਤਰ ਚੌਦਾਂ ਲੱਖ ਛੇ ਹਜ਼ਾਰ ਸੱਤ ਸੌ ਸਤਵੰਜਾ